ਸਾਡੇ ਜੀਵਨ ਵਿੱਚ ਸੈਰ ਦਾ ਬਹੁਤ ਮਹੱਤਵ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਵੇਂ ਕਿ ਹੁਣ ਤਾਂ ਮੈਂ ਵੱਡਾ ਹੋ ਗਿਆ ਪਰ ਮੈਂ ਛੋਟਾ ਹੁੰਦਾ ਸੀ ਤਦ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਕਿਤੇ ਨਾ ਕਿਤੇ ਸੈਰ ਸਪਾਟਾ ਕਰਨ ਚਲਾ ਜਾਂਦਾ ਸੀ ਕਿਵੇਂ ਕਿ ਅਸੀਂ ਸਾਰੇ ਦੋਸਤ ਮਿਲ ਜੁਲ ਕੇ ਸੈਰ ਕਰਨ ਜਾਂਦੇ ਸੀ ਸੈਰ ਕਰਦੇ ਕਰਦੇ ਕਿਤੇ ਨਾ ਕਿਤੇ ਪੁੱਜ ਜਾਂਦੇ ਸੀ ਤਾਂ ਕਦੇ ਕਿਸੇ ਦੇ ਘਰ ਚਲੇ ਜਾਣਾ ਕਦੇ ਪਾਰਕ ਵੀ ਚਲੇ ਜਾਣਾ ਦੋਸਤਾਂ ਨਾਲ ਅਤੇ ਇਸੇ ਕਾਰਨ ਅਸੀਂ ਛੋਟੇ ਹੁੰਦੇ ਕਿਤੇ ਨਾ ਕਿਤੇ ਘੁੰਮਦੇ ਰਹਿੰਦੇ ਸੀ ਸੈਰ ਸਪਾਟਾ ਕਰਨ ਨਾਲ ਸਾਡੀ ਤਾਂ ਸਾਡੀ ਲੱਤਾਂ ਵਿੱਚ ਜਾਨ ਆਉਂਦੀ ਆ ਸਾਡੀ ਸ ਸਿਹਤ ਫਲਦੀ ਫੁਲਦੀ ਰਹਿੰਦੀ ਸੀ ਸੈਰ ਕਰਨ ਨਾਲ ਹੀ ਸਾਡੀ ਸਿਹਤ ਬਣੀ ਰਹਿੰਦੀ ਸੀ ਯਾਰਾਂ ਦੋਸਤਾਂ ਨਾਲ ਅਸੀਂ ਮਿਲ ਕੇ ਕਦੇ ਕਿਤੇ ਕੁਝ ਖਾਣ ਪੀਣ ਚਲੇ ਜਾਣਾ ਕਦੇ ਕਿਤੇ ਘੁੰਮਣ ਚਲੇ ਜਾਣਾ ਇਹਨਾਂ ਦੇ ਨਾਲ ਹੀ ਸਾਡੀ ਜੀਵਨ ਸ਼ਕਤੀ ਬਣਦੀ ਸੀ ਪਰ ਛੋਟੇ ਹੁੰਦੇ ਗੱਲ ਕੁਝ ਹੋਰ ਸੀ ਹੁਣ ਤਾਂ ਅਸੀਂ ਵੱਡੇ ਹੋ ਗਏ ਹਾਂ ਹੁਣ ਤਾਂ ਸਾਡੀ ਜ਼ਿੰਦਗੀ ਸਾਰਿਆਂ ਦੀ ਅਲੱਗ ਅਲੱਗ ਹੋ ਗਈ ਹੈ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲ ਗਿਆ ਹੁਣ ਤਾਂ ਪੁਰਾਣੇ ਦੋਸਤਾਂ ਬਾਰੇ ਪਤਾ ਹੀ ਹੈ ਨਹੀਂ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ ਸਾਰੇ ਦੋਸਤ ਅਲੱਗ ਹੋ ਗਏ ਹਨ ਹੁਣ ਮੈਂ ਹੀ ਹਾਂ ਕਿਤੇ ਬਾਹਰ ਰਹਿੰਦਾ ਮੇਰੇ ਦੋਸਤ ਕਿਤੇ ਹੋਰ ਰਹਿੰਦੇ ਹੁਣ ਅੱਜ ਕੱਲ੍ਹ ਤਾਂ ਸੈਰ ਸਪਾਟਾ ਕਰਨਾ ਤਾਂ ਦੂਰ ਦੀ ਗੱਲ ਛੋਟੇ ਹੁੰਦੇ ਜੋ ਮਜ਼ੇ ਸੀ ਪਰ ਵੱਡੇ ਹੋ ਕੇ ਉਹ ਮਜ਼ੇ ਨਹੀਂ ਸੀ ਅਤੇ ਹੁਣ ਵੀ ਅਸੀਂ ਘੱਟ ਵੱਧ ਹੀ ਕਦੇ ਕਿਤੇ ਦੋਸਤਾਂ ਨਾਲ ਕਿਤੇ ਚਲੇ ਜਾਈਦਾ ਪਰ ਘੱਟ ਵੱਧ ਹੀ ਜਿਵੇਂ ਕਿ ਛੋਟੇ ਹੁੰਦੇ ਜਾਂਦੇ ਸੀ ਪਰ ਹੁਣ ਉਹ ਮਜ਼ਾ ਨਹੀਂ ਰਿਹਾ ਧੰਨਵਾਦ